ਸਤਿ ਸ੍ਰੀ ਅਕਾਲ ਮੈਮ ਮੈਮ ਮੈਂ ਸੁਮਨ ਗੱਲ ਕਰ ਰਹੀ ਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਮੈਮ ਹਾਂਜੀ ਬਿਲਕੁਲ ਮੈਮ ਜਿਹੜੀ ਪੰਜਾਬ ਦੀ ਧਰਤੀ ਮੈਮ ਹਮੇਸ਼ਾ ਤੋਂ ਹੀ ਗੁਰੂਆਂ ਦੀ ਧਰਤੀ ਰਹੀ ਹੈ ਇਸ ਧਰਤੀ ਤੇ ਕਾਫੀ ਇਦਾਂ ਦੇ ਫਰੀਡਮ ਫਾਈਟਰ ਹੋਏ ਨੇ ਜਿਨਾਂ ਨੇ ਆਪਣਾ ਲਹੂ ਡੋਲ ਕੇ ਆਜ਼ਾਦੀ ਵਿੱਚ ਆਪਣਾ ਯੋਗਦਾਨ ਪਾਇਆ ਹੈ ਤੇ ਇਹੋ ਜਿਹੇ ਹੀ ਆਪਾਂ ਫਰੀਡਮ ਫਾਈਟਰਾਂ ਜੇ ਅਗਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਸਾਡੇ ਜਿਹੜੇ ਨਾਮ ਜਹਿਨ ਵਿੱਚ ਆਉਂਦੇ ਨੇ ਉਹ ਆਉਂਦਾ ਭਗਤ ਸਿੰਘ ਦਾ ਰਾਜਗੁਰੂ ਦਾ ਸੁਖਦੇਵ ਦਾ ਜਿਹਨਾਂ ਨੇ ਅੰਗਰੇਜ਼ਾਂ ਨੂੰ ਅੰਗਰੇਜ਼ਾਂ ਦੀਆਂ ਜਿਹੜੀਆਂ ਜਿਹੜੀ ਉਹਨਾਂ ਦੀ ਚੱਲਦੀਆਂ ਪਈਆਂ ਸੀ ਸਰਗਰਮੀਆਂ ਭਾਰਤ ਦੇ ਵਿੱਚ ਆਜ਼ਾਦੀ ਵਿੱਚ ਉਹਨਾਂ ਨੇ ਕਾਫੀ ਵੱਡਾ ਜਿਹੜਾ ਯੋਗਦਾਨ ਏ ਉਹ ਪਾਇਆ ਪਰ ਹਰ ਤਰਹਾਂ ਦੀ ਲੜਾਈ ਉਹਨਾਂ ਨੇ ਡੱਟ ਕੇ ਲੜੀ ਹੈ ਆਪਾਂ ਦੇਖੀਏ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਉਹ ਨੌਜਵਾਨਾਂ ਨੂੰ ਆਪਣੇ ਸਿਰਫ ਉਹਨਾਂ ਨੂੰ ਪਈ ਹੈ ਕਿ ਆਪਾਂ ਖਾ ਪੀ ਲਈਏ ਆਪਾਂ ਚੰਗੀ ਚੀਜ਼ ਲੈ ਲਈਏ ਆਪਾਂ ਐਸ਼ ਪ੍ਰਸਤੀ ਕਰ ਲਈਏ ਪਰ ਅਗਰ ਆਪਾਂ ਧਿਆਨ ਨਾਲ ਵੇਖੀਏ ਤੇ ਜਿਹੜੇ ਭਗਤ ਸਿੰਘ ਰਾਜਗੁਰੂ ਸੁਖਦੇਵ ਸੀ ਖਾਸ ਕਰਕੇ ਭਗਤ ਸਿੰਘ ਬਹੁਤ ਹੀ ਛੋਟੀ ਉਮਰ ਵਿੱਚ ਉਹ ਇਸ ਰਸਤਾ ਉਹਨਾਂ ਨੇ ਚੁਣ ਲਿਆ ਸੀ ਕਿ ਜਿੱਥੇ ਉਹਨਾਂ ਨੇ ਆਪਣੇ ਦੇਸ਼ ਲਈ ਕੁਝ ਕਰਨ ਲਈ ਕਰਨ ਦੀ ਖਾਤਿਰ ਹੀ ਸਮਝਿਆ ਕਿ ਆਪਾਂ ਠੀਕ ਰਵਾਂਗੇ ਨਾ ਕਿ ਇਧਰ ਉਧਰ ਆਪਣਾ ਸਮਾਂ ਖਰਾਬ ਕੀਤਾ ਅੱਜਕੱਲ ਦੇ ਨੌਜਵਾਨ ਕੀ ਕਰਦੇ ਨਸ਼ਿਆਂ ਵੱਲ ਨੂੰ ਬਹੁਤ ਜਾਂਦੇ ਪਰ ਉਸ ਟਾਈਮ ਦੇ ਉਸ ਸਮੇਂ ਦੇ ਜਿਹੜੇ ਨੌਜਵਾਨ ਸੀਗੇ ਪੰਜਾਬ ਦੇ ਫਰੀਡਮ ਫਾਈਟਰ ਰਹਿ ਚੁੱਕੇ ਨੇ ਉਹਨਾਂ ਨੂੰ ਅੱਜ ਵੀ ਆਪਾਂ ਦਿਲੋਂ ਸਨਮਾਨ ਕਰਦੇ ਆਂ ਕਿ ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਉਹਨਾਂ ਦੇ ਕਰਕੇ ਹੀ ਅੱਜ ਅਸੀਂ ਆਜ਼ਾਦ ਘੁਮ ਪਾ ਰਹੇ ਆਂ ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੇ ਅੱਜ ਦੇ ਪੰਜਾਬ ਦੇ ਨੌਜਵਾਨ ਨੇ ਉਹ ਇਸ ਗੱਲ ਨੂੰ ਸਮਝ ਨੀ ਪਾ ਰਹੇ ਇਸ ਕਰਕੇ ਲੋੜ ਹੈ ਕਿ ਉਹਨਾਂ ਨੂੰ ਵੀ ਪੰਜਾਬ ਦੇ ਜਿਹੜੇ ਫਰੀਡਮ ਫਾਈਟਰ ਰਹਿ ਚੁੱਕੇ ਨੇ ਉਹਨਾਂ ਬਾਰੇ ਜਾਣੂ ਕਰਵਾਇਆ ਜਾਵੇ ਚਾਹੇ ਇਹਨਾਂ ਵਿੱਚ ਜਿਹੜੇ ਰਾਜਗੁਰੂ ਸੁਖਦੇਵ ਸੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਔਰ ਉਹ ਫਾਂਸੀ ਦੀ ਸਜ਼ਾ ਵੀ ਕਿਉਂ ਹੋਈ ਅਗਰ ਦੇਖਿਆ ਜਾਵੇ ਤਾਂ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਸੀ ਪਰ ਫਿਰ ਵੀ ਜਿਹੜੇ ਅੰਗਰੇਜ ਸੀਗੇ ਜਿਨਾਂ ਨੇ ਭਾਰਤ ਤੇ ਕਬਜ਼ਾ ਕੀਤਾ ਹੋਇਆ ਸੀ ਉਹਨਾਂ ਨੇ ਆਪਣੀ ਈਨ ਨਾ ਮੰਨਦੇ ਹੋਏ ਇਹਨਾਂ ਨੌਜਵਾਨਾਂ ਦਾ ਲਹੂ ਡੋਲਿਆ ਔਰ ਉਸ ਟਾਈਮ ਤਾਂ ਜਿਹੜਾ ਭਗਤ ਸਿੰਘ ਸੀ ਉਹ ਵਿਚਾਰਾ ਤੇ ਹੱਲੇ ਕੁਆਰਾ ਹੀ ਸੀ ਉਹਦੇ ਤੇ ਵਿਆਹ ਵੀ ਨਹੀਂ ਸੀ ਹੋਇਆ ਤੇ ਅੱਜ ਕਦੇ ਨੌਜਵਾਨ ਪੀੜੀ ਹੈ ਉਹਨਾਂ ਨੂੰ ਬਿਲਕੁਲ ਹੀ ਕੋਈ ਮਤਲਬ ਨਹੀਂ ਕਿ ਆਪਾਂ ਦੇਸ਼ ਦੇ ਲਈ ਕੁਝ ਕਰਨਾ ਹੈ ਜਾਂ ਆਪਾਂ ਕੁਝ ਆਪਾਂ ਯੋਗਦਾਨ ਪਾਈਏ ਪਰ ਜੇ ਜੇਕਰ ਅਸੀਂ ਫਰੀਡਮ ਫਾਈਟਰ ਦੀ ਗੱਲ ਕਰਦੇ ਆ ਤੇ ਮੈਨੂੰ ਨਹੀਂ ਲੱਗਦਾ ਕਿਸੇ ਦੇ ਵੀ ਜਹਿਨ ਵਿੱਚ ਇਹਨਾਂ ਤਿੰਨਾਂ ਨਾਮਾਂ ਤੋਂ ਉੱਪਰ ਕਿਸੇ ਹੋਰ ਦਾ ਨਾਮ ਆਉਂਦਾ ਹੋਏਗਾ ਕਿਉਂਕਿ ਇਹਨਾਂ ਨੇ ਜੋ ਕੁਰਬਾਨੀਆਂ ਕੀਤੀਆਂ ਉਹ ਲਾਸਾਨੀ ਕੁਰਬਾਨੀਆਂ ਸੀ ਜਿਨਾਂ ਅੱਗੇ ਹੋਰ ਕਿਸੇ ਦੀ ਵੀ ਕੁਰਬਾਨੀ ਨੂੰ ਆਪਾਂ ਬਿਲਕੁਲ ਦੇਖ ਵੀ ਨੀ ਸਕਦੇ

ਠੀਕ ਐ ਜਰੂਰ ਮੈਮ ਧੰਨਵਾਦ